ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਇੱਥੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਹਰੇਕ ਲੋਕਾਂ ਦੀ ਅਲੱਗ ਅਲੱਗ ਨਾਚ ਸ਼ੈਲੀ ਹੈ ਜਿਵੇਂ ਕਿ ਪੰਜਾਬੀਆਂ ਦਾ ਭੰਗੜਾ ਗਿੱਧਾ ਅਤੇ ਮੈਨੂੰ ਮਸ਼ਹੂਰ ਡਾਂਸਰਾਂ ਵਿੱਚੋਂ ਮਾਝੇ ਦੀ ਸ਼ੀਤ ਦਾ ਡਾਂਸ ਬਹੁਤ ਵਧੀਆ ਲੱਗਦਾ ਹੈ ਉਹ ਮਸ਼ਹੂਰ ਡਾਂਸਰ ਦੇ ਨਾਲ਼ ਨਾਲ਼ ਫ਼ਿਲਮੀ ਐਕਟਰਸ ਵੀ ਹੈ ਅਤੇ ਉਹਨਾਂ ਦੀ ਡਾਂਸ ਕਰਕੇ ਹੀ ਉਹਨਾਂ ਦੀ ਪਹਿਚਾਣ ਹੈ ਅਤੇ ਮੈਨੂੰ ਉਹਨਾਂ ਦਾ ਡਾਂਸ ਬਹੁਤ ਵਧੀਆ ਲੱਗਦਾ ਹੈ ਅਤੇ ਉਹਨਾਂ ਦਾ ਕਾਫ਼ੀ ਸਮੇਂ ਤੋਂ ਡਾਂਸ ਚੱਲਦਾ ਹੈ ਫ਼ਿਲਮਾਂ ਵਿੱਚ ਉਹ ਆਪਣਾ ਕਿਰਦਾਰ ਨਿਭਾ ਰਹੇ ਹਨ ਅਤੇ ਉਹਨਾਂ ਦਾ ਹੁਣ ਤੱਕ ਵੀ ਡਾਂਸ ਅਤੇ ਫਿਲਮਾਂ ਹੀ ਤਜ਼ਰਬਾ ਬਹੁਤ ਵਧੀਆ ਹੈ